ਮੇਰੀ ਰੁਚੀ ਕ੍ਰਿਕਟ ਵਿੱਚ ਹੈ ਇਸ ਵਿੱਚ ਦਿੱਤੇ ਜਾਣ ਵਾਲੇ ਮੈਡਲ ਟਰੋਫੀਆਂ ਕੁਝ ਇਸ ਪ੍ਰਕਾਰ ਹਨ ਵਲਡ ਕੱਪ ਓ ਡੀ ਆਈ ਵਲਡ ਕੱਪ ਟਵੰਟੀ ਟਵੰਟੀ ਵਰਲਡ ਕੱਪ ਚੈਂਪੀਅਨ ਟਰੋਫੀ ਟੈਸਟ ਮੇਜ ਹੁਣ ਇਹਨਾਂ ਵਿੱਚੋਂ ਇਹ ਪ੍ਰਾਪਤੀਆਂ ਪ੍ਰਾਪਤ ਕਰਨ ਲਈ ਕੁਝ ਸਮਾਗਮ ਹੁੰਦੇ ਹਨ ਜਿਵੇਂ ਕਿ ਵਲਡ ਕੱਪ ਜੋ ਕਿ ਵਿਸ਼ਵ ਪੱਧਰ 'ਤੇ ਖੇਡਿਆ ਜਾਂਦਾ ਹੈ ਇਸ ਵਿੱਚ ਹਿੱਸਾ ਲੈ ਕੇ ਅਲੱਗ ਅਲੱਗ ਟੀਮਾਂ ਆਪਣੇ ਦਾਅਵੇਦਾਰੀ ਪੇਸ਼ ਕਰਦੀਆਂ ਹਨ ਜੋ ਜੇਤੂ ਟੀਮਾਂ ਹੁੰਦੀਆਂ ਹਨ ਉਹ ਅੱਗੇ ਜਾ ਕੇ ਸੈਮੀਫਾਈਨਲ ਅਤੇ ਫਿਰ ਫਾਈਨਲ ਵਿੱਚ ਭਿੜਦੀਆਂ ਹਨ ਫਾਈਨਲ ਵਿੱਚ ਜੇਤੂ ਟੀਮ ਇਹ ਖਿਤਾਬ ਆਪਣੇ ਨਾਮ ਕਰ ਲੈਂਦੀ ਹੈ ਅਤੇ ਜੇਤੂ ਅਖਵਾਉਂਦੀ ਹੈ ਅਤੇ ਇਹ ਸਮਾਗਮਾਂ ਵਿੱਚੋਂ ਜਿੱਤ ਜਾਂਦੀ ਹੈ